ਮੈਂ ਇਕਬਾਲ ਪੰਜਾਬੀ ਦਾ ਇੱਕ ਕਿਤਾਬ ਮੈਂ ਪੜ੍ਹੀ ਹੈ ਵਾਕੇ ਬਹੁਤ ਅੱਛੀ ਹੈ ਉਹ ਤਾਂ ਉੱਚੀ ਉੱਚੀ ਹੱਸਣ ਲਈ ਮਜ਼ਬੂਰ ਵੀ ਕਰਦੀ ਹੈ ਇਹਦੇ ਵਿੱਚ ਕੀ ਸੀਗਾ ਇਹ ਕਿਤਾਬ ਬਾਰੇ ਜੋ ਹੱਸਿਆ ਇਹਦੇ ਵਿੱਚ ਇਕਬਾਲ ਪੰਜਾਬੀ ਵਾਰ ਵਾਰ ਪੜ੍ਹੀ ਜਾਈਦਾ ਸੀ ਅਤੇ ਉਹ ਮਤਲਬ ਉੱਚੀ ਉੱਚੀ ਹਾਸਾ ਆਉਂਦਾ ਸੀਗਾ ਅਤੇ ਉੱਚੀ ਉੱਚੀ ਹੱਸਣ ਲਈ ਮਜ਼ਬੂਰ ਬੰਦਾ ਹੋ ਜਾਂਦਾ ਤਕਰੀਬਨ ਇਸੇ ਕਿਤਾਬ ਦੇ ਵਿੱਚ ਇਹੋ ਕੁਛ ਸਾਰਾ ਇਤਿਹਾਸ ਲਿਖਿਆ ਹੋਇਆ ਅਤੇ ਪੰਜਾਬੀ ਵਿੱਚ ਕਿਤਾਬ ਹੈ ਬਾਕੀ ਤਾਂ ਇਹ ਕਿਤਾਬ ਅੱਛੀ ਲੱਗੀ ਮੈਨੂੰ ਠੀਕ ਹੈ ਓਕੇ